ਸਤਿ ਸ਼੍ਰੀ ਅਕਾਲ ਭੈਣੇ ਹਾਂ ਹਾਂ ਵਧੀਆ ਤੁਸੀਂ ਠੀਕ ਹੋ ਮੰਮੀ ਡੈਡੀ ਠੀਕ ਨੇ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਤੁਹਾਡਾ ਵੀਜ਼ਾ ਲੱਗ ਗਿਆ ਹਾਂ ਤੁਹਾਡਾ ਅਮਰੀਕਾ ਦਾ ਵੀਜ਼ਾ ਲੱਗ ਗਿਆ ਅਤੇ ਮੇਰਾ ਗਰਮੀ ਦਾ ਕਰਕੇ ਨਾ ਆਪਣੀਆਂ ਫਲਾਈਟ ਬੰਦ ਹੋਣਗੀਆਂ ਇਸ ਕਰਕੇ ਆਪਾਂ ਨੂੰ ਥੋੜ੍ਹਾ ਛੇਤੀ ਟਿਕਟ ਬੁੱਕ ਕਰਨੀ ਪਊਗੀ ਕੋਈ ਗੱਲ ਨਹੀਂ ਆਪਾਂ ਨਾ ਅੱਜ ਹੀ ਚਲੇ ਜਾਵਾਂਗੇ ਅਤੇ ਆਪਾਂ ਸ਼ੌਪਿੰਗ ਦਾ ਸਮਾਨ ਸਾਰੇ ਕਰ ਲਿਆਵਾਂਗੇ ਕੇਰਾਂ ਬਾਕੀ ਜਿਹੜਾ ਹਾਂ ਉਹਨਾਂ ਨਾਲ ਮੇਰੀ ਗੱਲ ਹੋ ਗਈ ਹੈ ਵੈਸੇ ਇੱਕ ਵਾਰ ਤੁਸੀਂ ਵੀ ਦੱਸ ਦਿਓ ਹਾਂ ਅਤੇ ਉਹਨਾਂ ਨੂੰ ਪੁੱਛ ਲਿਓ ਆਪਾਂ ਸ਼ੋਪਿੰਗ ਕਰਨ ਚੱਲ ਪਵਾਂਗੇ ਹਾਂ ਹਾਂ ਆ ਜਾਇਓ ਤੁਸੀਂ ਕੋਈ ਗੱਲ ਨਹੀਂ ਤੁਸੀਂ ਪੰਜ ਵਜੇ ਤੋਂ ਬਾਅਦ ਆ ਜਾਓ ਫਿਲਹਾਲ ਤਾਂ ਮੈਂ ਆਫਿਸ ਹਾਂ ਤੁਸੀਂ ਪੰਜ ਵਜੇ ਤੋਂ ਬਾਅਦ ਆ ਜਾਇਓ ਅਤੇ ਜਿਹੜਾ ਸਮਾਨ ਤੁਹਾਡੇ ਕੋਲ ਹੈਗਾ ਫਿਲਹਾਲ ਤੁਸੀਂ ਉਹ ਪੈਕ ਕਰ ਲਓ ਅਤੇ ਲਾਈਕ ਤਾਂ ਆਪਾਂ ਹਜੇ ਟਿਕੀ ਟਿਕਟ ਬੁੱਕ ਨਹੀਂ ਕਰਵਾਈ ਗੀ ਉਹ ਦੇਖਦੇ ਹੈਗੇ ਹਜੇ ਆਪਾਂ ਹਾਂ ਹਾਂ ਤੇ ਤੁਸੀਂ ਆ ਜਾਇਓ ਸ਼ਾਮ ਪੰਜ ਵਜੇ ਤੋਂ ਬਾਅਦ

ਹਾਂ ਹਾਂ ਕੋਈ ਗੱਲ ਨਹੀਂ ਅਤੇ ਇੱਕ ਤੁਸੀਂ ਆਪਦੇ ਫ੍ਰੈਂਡਸ ਨੂੰ ਦੱਸ ਦਿਓ ਮਾੜਾ ਜਿਹਾ ਮਿਲ ਜਾਣਗੇ ਮੁੜਕੇ ਪੰਜ ਸਾਲਾਂ ਬਾਅਦ ਆਉਣਾ ਤੁਸੀਂ ਅਤੇ ਤੁਸੀ ਸ਼ੋਪਿੰਗ 'ਚ ਕੀ ਕੀ ਦੇਖਣਾ ਲੈਣਾ ਉਹਦੀ ਲਿਸਟ ਬਣਾ ਲਿਓ ਲਿਖ ਕੇ ਠੀਕ ਹੈ ਠੀਕ ਹੈ ਜਿਹੜਾ ਕੁਛ ਤੁਹਾਨੂੰ ਇੱਕ ਵਾਰ ਤੁਸੀਂ ਦੇਖ ਲਿਓ ਆਪਣੇ ਜਿਹੜਾ ਆਪਣੇ ਸ਼ਹਿਰ ਤੋਂ ਮਿਲਦਾ ਸਮਾਨ ਤੁਸੀਂ ਉਹ ਵਾਲਾ ਸਮਾਨ ਉੱਥੋਂ ਲੈ ਲਿਓ ਬਾਕੀ ਸਮਾਨ ਆਪਾਂ ਇੱਥੋਂ ਲੈ ਲਾਂਗੇ ਠੀਕ ਹੈ ਕੋਈ ਗੱਲ ਨਹੀਂ ਮੈਂ ਉਹਨਾਂ ਨਾਲ ਗੱਲ ਕਰ ਲੈਂਦਾ ਇਕ ਵਾਰ ਹਾਂ ਚਲੋ ਠੀਕ ਹੈ ਇਕ ਬਹੁਤ ਬਹੁਤ ਮੁਬਾਰਕਾਂ ਦੁਬਾਰਾ ਤੁਹਾਨੂੰ ਠੀਕ ਹੈ ਓਕੇ